ਪੰਜਾਬ ਵਿੱਚ ਕਈ ਧਰਮ ਹਨ ਜਿਵੇਂ ਕਿ ਹਿੰਦੂ ਇਸਲਾਮ ਬੁੱ ਬੁੱਧ ਧਰਮ ਅਤੇ ਸਿੱਖ ਧਰਮ ਮੈਂ ਸਿੱਖ ਧਰਮ ਨਾਲ ਬਿਲੋਂਗ ਕਰਦੀ ਹਾਂ ਸਿੱਖ ਧਰਮ ਵਿੱਚ ਕਈ ਤਰ੍ਹਾਂ ਦੇ ਗੁਰਦੁਆਰੇ ਵੀ ਹਨ ਜਿਵੇਂ ਕਿ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਅਤੇ ਉੱਥੇ ਉੱਥੇ ਆਪਣੇ ਕਰਤੱਵ ਦਿਖਾਏ ਜਾਂਦੇ ਹਨ ਸਿੰਘ ਆਪਣੇ ਕਰਤੱਵ ਦਿਖਾਉਂਦੇ ਹਨ ਅਤੇ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦਿੱਤੀ ਸੀ ਅਤੇ ਉਹਨਾਂ ਨੂੰ ਨੀਹਾਂ ਵਿੱਚ ਜਿੰਦਾ ਹੀ ਚ ਨੀਹਾਂ ਵਿੱਚ ਚਿਣ ਦਿੱਤਾ ਸੀ ਅਤੇ ਉਹਨਾਂ ਦੀ ਬਹਿਰ ਬਹੁਤ ਬੇਰਹਿਮੀ ਨਾਲ ਮੌਤ ਹੋ ਗਈ ਸੀ